ਸਿੱਖਿਅਤ ਹੋਣਾ ਮੌਜੂਦਾ ਸਮੇਂ ਵਿੱਚ ਬਹੁਤ ਹੀ ਫਾਇਦੇਮੰਦ ਹੈ ਸਿੱਖਿਅਤ ਵਿਅਕਤੀ ਦਾ ਰਹਿਣਾ ਸਹਿਣਾ ਅਤੇ ਕਿਸੇ ਵੀ ਵਿਅਕਤੀ ਨਾਲ ਗੱਲ ਕਰਨ ਦਾ ਢੰਗ ਬਹੁਤ ਹੀ ਵਧੀਆ ਹੁੰਦਾ ਹੈ ਸਿੱਖਿਅਤ ਹੋਣਾ ਸਮਾਜ ਵਿੱਚ ਇੱਕ ਇੱਜਤਦਾਰ ਕੰਮ ਹੈ ਸਿੱਖਿਅਤ ਵਿਅਕਤੀ ਨੂੰ ਹੀ ਆਪਣੇ ਸ਼ਿਕਸ਼ਾ ਦੇ ਜਰੀਏ ਇੱਕ ਸਰਕਾਰੀ ਨੌਕਰੀ ਮਿਲ ਸਕਦੀ ਹੈ ਜਿਸ ਨਾਲ ਉਹ ਆਪਣੀ ਜੀਵਨ ਦਾ ਗੁਜ਼ਾਰਾ ਕਰ ਸਕਦਾ ਹੈ ਇਸ ਤੋਂ ਇਲਾਵਾ ਅਨਪੜ੍ਹ ਵਿਅਕਤੀ ਨੂੰ ਬਹੁਤ ਸਾਰੀਆਂ ਪਰੇਸ਼ਾਨੀਆਂ ਨਾਲ ਖੁੰਜਰਨਾ ਪੈਂਦਾ ਹੈ ਇਹ ਸਮਾਜ ਅਨਪੜ੍ਹ ਵਿਅਕਤੀ ਦੀ ਇੱਜਤ ਨਹੀਂ ਕਰਦਾ ਏ ਉਸ ਨੂੰ ਵੱਡੇ ਵੱਡੇ ਮੋਲਾਂ ਵਿੱਚ ਵੀ ਨਹੀਂ ਜਾਣ ਦਿੱਤਾ ਜਾਂਦਾ ਅਮੀਰ ਲੋਕ ਉਸ ਤੋਂ ਪਰੇ ਪਰੇ ਰਹਿੰਦੇ ਹਨ ਅਨਪੜ੍ਹ ਦੀ ਨਿਸ਼ਾਨੀ ਉਸਦੇ ਪਹਿਨਾਵੇ ਅਤੇ ਬੋਲਬਾਣੀ ਤੋਂ ਲਗਾਈ ਜਾ ਸਕਦੀ ਹੈ ਇਸ ਤੋਂ ਇਲਾਵਾ ਸਰਕਾਰੀ ਨੌਕਰੀ ਸਿਰਫ ਸਿੱਖਿਅਤ ਵਿਅਕਤੀ ਨੂੰ ਹੀ ਮਿਲਦੀ ਹੈ ਅਨਪੜ੍ਹ ਵਿਅਕਤੀ ਦੇ ਹੱਥ ਕੁਛ ਵੀ ਨਹੀਂ ਆਉਂਦਾ ਅਨਪੜ੍ਹ ਵਿਅਕਤੀ ਨੂੰ ਹੀ ਦਿਹਾੜੀ ਕਰਨੀ ਪੈਂਦੀ ਹੈ ਕਿਉਂ